ਇੱਕ ਵਾਰੀ ਇਹ ਆਨੰਦਪੁਰ ਸਾਹਿਬ ਗਏ ਸੀ ਗੁਰਦੁਆਰਾ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੋ ਕਿ ਗੁਰੂ ਗੋੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਪਵਿੱਤਰ ਸਥਾਨ ਹੈ ਇੱਥੇ ਬਹੁਤ ਗੁਰਦੁਆਰੇ ਦੇਖਣ ਨੂੰ ਹੈ ਅਤੇ ਇੱਕ ਅਜੂਬਾ ਵੀ ਹੈ ਅਤੇ ਅਸੀਂ ਅਜੂਬੇ ਵਿੱਚ ਘੁੰਮਣ ਗਏ ਸੀ ਅਜੂਬੇ ਵਿੱਚ ਬਹੁਤ ਤਰ੍ਹਾਂ ਦੀਆਂ ਗੁਰੂਆਂ ਦੀਆਂ ਫੋਟੋਆਂ ਇਤਿਹਾਸਕ ਲਾਈਆ ਹੋਈਆਂ ਸੀ ਜੋ ਸਾਨੂੰ ਗੁਰੂਆਂ ਬਾਰੇ ਦੱਸ ਰਹੀਆਂ ਸਨ ਅਜੂਬੇ ਵਿੱਚ ਹੋਰ ਬਹੁਤ ਕਈ ਆਈਟਮਾਂ ਐ ਜੋ ਪੰਜਾਬ ਦਾ ਇਤਿਹਾਸ ਪੁਚੋਂਦੀਆਂ ਹਨ ਇਹ ਆਨੰਦਪੁਰ ਸਾਹਿਬ ਵਿੱਚ ਹੈ ਆਨੰਦਪੁਰ ਸਾਹਿਬ ਤਾਂ ਥੋੜ੍ਹੀ ਦੂਰ 'ਤੇ ਸਥਿਤ ਹੈ ਅਤੇ ਆਨੰਦਪੁਰ ਸਾਹਿਬ ਵਿੱਚ ਹੋਰ ਕਈ ਗੁਰਦੁਆਰੇ ਇਤਿਹਾਸਿਕ ਗੁਰਦੁਆਰੇ ਹਨ ਇੱਥੇ ਹੋਰ ਕਈ ਹੋਰ ਇਤਿਹਾਸਕ ਗੁਰਦੁਆਰੇ ਵੀ ਹੈ ਜਿਨ੍ਹਾਂ ਨੂੰ ਅਸੀਂ ਬਹੁਤ ਘੁੰਮਣ ਵਿੱਚ ਸਾਨੂੰ ਮਨ ਬਹੁਤ ਲੱਗਿਆ ਅਤੇ ਇਸ ਗੁਰੂ ਘਰ ਵਿੱਚ ਲੰਗਰ ਵੀ ਬਹੁਤ ਵਧੀਆ ਚੱਲ ਰਿਹਾ ਸੀ ਜਿੱਥੇ ਅਸੀਂ ਲੰਗਰ ਖਾਧਾ ਤੇ ਸਾਨੂੰ ਲੰਗਰ ਬਹੁਤ ਸੁਆਦ ਲੱਗਿਆ ਗੁਰੂ ਘਰ ਦਾ ਇਤਿਹਾਸ ਬਹੁਤ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ